ਮੇਰਾ ਨਾਂ ਰਾਘਵ ਹੈ ਮੈਂ ਪਠਾਨਕੋਟ ਸ਼ਹਿਰ ਦਾ ਰਹਿਣ ਵਾਲਾ ਮੈਨੂੰ ਦੌੜ ਲਾਉਣੀ ਬਹੁਤ ਚੰਗੀ ਲੱਗਦੀ ਹੈ ਮੈਂ ਰੋਜ਼ ਸਵੇਰੇ ਆਪਣੇ ਦੋਸਤ ਨਾਲ ਦੌੜ ਲਾਉਣ ਜਾਂਦਾ ਹਾਂ ਜੇਕਰ ਗੱਲ ਕਰੀਏ ਮੇਰੇ ਸ਼ਹਿਰ ਵਿੱਚ ਕਈ ਸਕੂਲਾਂ ਵਿੱਚ ਕਈ ਤਰ੍ਹਾਂ ਦੀ ਗੇਮਾਂ ਖਿਡਾਈ ਜਾਂਦੀਆਂ ਹਨ ਜਿਨ੍ਹਾਂ ਵਿੱਚ ਅੱਠ ਸੌ ਮੀਟਰ ਦੌੜ ਚਾਰ ਸੌ ਮੀਟਰ ਕ੍ਰਿਕਟ ਆਦਿ ਗੇਮਾਂ ਚਈ ਕਈ ਜਗ੍ਹਾ 'ਤੇ ਦੌੜ ਲਾਉਣ ਵਾਲੀ ਗੇਮਾਂ ਖੇਡੀਆਂ ਜਾਂਦੀਆਂ ਹਨ ਜਿਸ ਕਰਕੇ ਬੱਚਿਆਂ ਦਾ ਸਰੀਰ ਵੀ ਤੰਦਰੁਸਤ ਰਹਿੰਦਾ ਹੈ ਦੌੜ ਲਾਉਣਾ ਬਹੁਤ ਵਧੀਆ ਹੈ ਉਸ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਵੱਧਦਾ ਫੁੱਲਦਾ ਰਹਿੰਦਾ ਹੈ ਜੇਕਰ ਗੱਲ ਕਰੀਏ ਛੋਟੇ ਬੱਚਿਆਂ ਦੀ ਤਾਂ ਛੋਟੇ ਬੱਚਿਆਂ ਨੂੰ ਵੀ ਦੌੜ ਲਾਉਣੀ ਚਾਹੀਦੀ ਹੈ ਛੋ ਦੌੜ ਲਾਉਣ ਨਾਲ ਬੱਚਿਆਂ ਦਾ ਸਰੀਰ ਮਜ਼ਬੂਤ ਅਤੇ ਸਖਤ ਬਣਦਾ ਹੈ ਜਿਸ ਜਿਸ ਕਰਕੇ ਉਹ ਤੰਦਰੁਸਤ ਰਹਿੰਦੇ ਹਨ ਅਤੇ ਉਹਨਾਂ ਨੂੰ ਕੋਈ ਬਿਮਾਰੀਆਂ ਨਹੀਂ ਲੱਗਦੀਆਂ ਬਿਮਾਰੀਆਂ ਤੋਂ ਬਚੇ ਰਹਿੰਦੇ ਹਨ ਮੇਰਾ ਇਹੀ ਕਹਿਣਾ ਹੈ ਕਿ ਹਰ ਸਕੂਲ ਵਿੱਚ ਇਹੋ ਦੌੜ ਲਾਉਣ ਵਾਲੀ ਗੇਮਾਂ ਖਿਡਾਉਣੀ ਚਾਹੀਦੀਆਂ ਹਨ ਜਿਸ ਨਾਲ ਸਰੀਰ ਮਜ਼ਬੂਤ ਰਹਿੰਦਾ ਹੈ ਅਤੇ ਬੱਚਿਆਂ ਨੂੰ ਕੋਈ ਬਿਮਾਰੀ ਨਹੀਂ ਰਹਿੰਦੀ ਹੈ ਖਾਸ ਕਰਕੇ ਬੱਚਿਆਂ ਨੂੰ ਸਵੇਰ ਦੀ ਦੌੜ ਲਾਉਣੀ ਚਾਹੀਦੀ ਹੈ ਸਵੇਰ ਦੀ ਦੌੜ ਦਾ ਇਹ ਫਾਇਦਾ ਹੁੰਦਾ ਹੈ ਕਿ ਬੱਚਿਆਂ ਨੂੰ ਇੱਕ ਤਾਂ ਸਵੇਰੇ ਤਾਜ਼ੀ ਹਵਾ ਮਿਲਦੀ ਹੈ ਅਤੇ ਉਹਨਾਂ ਨੂੰ ਅਲੱਗ ਅਲੱਗ ਤਰ੍ਹਾਂ ਦੇ ਵਾਤਾਵਰਨ ਸ਼ੁੱਧ ਵਾਤਾਵਰਨ ਵੀ ਦਿਖਣਾ ਮਿਲਦਾ ਹੈ ਸਵੇਰੇ ਰੋਡਾਂ 'ਤੇ ਰੋਡ ਮੋਟਰਸਾਈਲ ਸਕੂਟੀ ਵੀ ਘੱਟ ਹੁੰਦੀ ਹੈ ਇਸ ਕਰਕੇ ਉਹਨਾਂ ਨੂੰ ਦੌੜਨ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਮੇਰਾ ਤਾਂ ਇਹੀ ਕਹਿਣਾ ਹੈ ਕਿ ਹਰ ਸਕੂਲ ਵਿੱਚ ਦੌੜ ਦੌੜਾਂ ਲਾਉਣ ਵਾਲੀਆਂ ਗੇਮਾਂ ਖਿਡਾਈ ਜਾਣੀ ਚਾਹੀਦੀਆਂ ਹਨ ਅਤੇ ਬੱਚਿਆਂ ਨੂੰ ਬਿਠਾ ਕੇ ਬਿਠਾ ਕੇ ਕੋਈ ਗੇਮ ਨਹੀਂ ਕਿ ਬਾਹਰੀ ਗੇਮਾਂ ਹੀ ਖਿਲਾਣੀ ਚਾਹੀਦੀਆਂ ਹਨ ਜਿਸ ਕਰਕੇ ਉਹਨਾਂ ਦਾ ਸਰੀਰ ਤੰਦਰੁਸਤ ਅਤੇ ਮਜ਼ਬੂਤ ਬਣੇਗਾ